ਹੈਲੋ ਸਤਿ ਸ਼੍ਰੀ ਅਕਾਲ ਜੀ ਮੈਨੂੰ ਪੰਜਾ ਮੈਂ ਬਾਹਰਲੇ ਦੇਸ਼ ਤੋਂ ਆਈ ਹਾਂ ਮੈਨੂੰ ਪੰਜਾਬ ਦੇ ਸਟੇਟਾਂ ਬਾਰੇ ਜਾਣਕਾਰੀ ਦਿਓ ਹਾਂਜੀ ਹਮ ਹੈਲੋ ਹੈਲੋ ਹਾਂਜੀ ਠੀਕ ਹੈ ਜੀ ਥੈਂਕਸ